ਮੇਰੀ ਇਹ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਮੈਂ ਹਰ ਗੱਲ ਮੂੰਹ 'ਤੇ ਬੋਲ ਦਿੰਦੀ ਹਾਂ ਮੈਂ ਕਿਸੇ ਤੋਂ ਬੋਲਣ ਲੱਗੇ ਡਰਦੀ ਨਹੀਂ ਬਟ ਇਹ ਗੱਲ ਮੇਨ ਉਦੋਂ ਹੀ ਹੁੰਦੀ ਹੈ ਜਦੋਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਤਾਂ ਗੁੱਸੇ ਵਿੱਚ ਮੈਂ ਸਭ ਕੁਛ ਬੋਲ ਦਿੰਦੀ ਹਾਂ ਜੋ ਮੈਂ ਬੋਲਣਾ ਚਾਹੁੰਦੀ ਹਾਂ ਜੋ ਮੇਰੇ ਮਨ ਵਿੱਚ ਆਉਂਦਾ ਆ ਉਹ ਗੱਲ ਚਾਹੇ ਨੈਕਸਟ ਪਰਸਨ ਨੂੰ ਬੁਰੀ ਲੱਗੇ ਜਾਂ ਚੰਗੀ ਲੱਗੇ ਪਰ ਮੈਂ ਸਾਰਾ ਕੁਛ ਉਸ ਦੇ ਸਾਹਮਣੇ ਬੋਲ ਦਿੰਦੀ ਹਾਂ ਤਾਂ ਕਿ ਮੈਨੂੰ ਉਹ ਚੀਜ਼ ਫੀਲ ਨਾ ਹੋਵੇ ਅਤੇ ਆਹ ਚੀਜ਼ ਮੈਨੂੰ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਅਤੇ ਇਸ ਦੇ ਨਾਲ਼ ਮੇਰੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਵੀ ਹਨ ਜਿਵੇਂ ਕਿ ਹਰ ਗੱਲ ਮੂੰਹ 'ਤੇ ਨਹੀਂ ਬੋਲ ਹੁੰਦੀ ਕਈ ਵਾਰੀ ਕਈ ਵਾਰੀ ਸਾਹਮਣੇ ਵਾਲੇ ਪਰਸਨ ਤੋਂ ਡਰ ਡਰ ਇਨ ਦਾ ਸੈਨਸ ਆਪਾਂ ਕਹਿ ਸਕਦੇ ਹਾਂ ਵੀ ਉਹ ਹਿੰਮਤ ਨਹੀਂ ਆਉਂਦੀ ਕਿ ਉਹ ਸਾਹਮਣੇ ਵਾਲੇ ਪਰਸਨ ਨੂੰ ਆਪਾਂ ਉਹ ਸਾਰਾ ਕੁਛ ਬੋਲ ਸਕੀਏ ਜੋ ਆਪਣੇ ਮਨ ਦੇ ਵਿੱਚ ਹੁੰਦਾ ਆ ਅਤੇ ਕਿਸੇ ਪਰਸਨ ਨੂੰ ਨਾ ਨਹੀਂ ਕਰ ਪਾਉਂਦੀ ਮਤਲਬ ਆਪਾਂ ਹਰ ਕੰਮ ਲਈ ਹਾਂ ਕਰਦੇ ਹਾਂ ਹੈ ਨਾ ਬੰਦੇ ਨੂੰ ਬੰਦਾ ਸੋਚਦਾ ਕਿ ਹਾਂਜੀ ਇਹਨੇ ਤਾਂ ਮੇਰਾ ਕੰਮ ਕਰ ਹੀ ਦੇਣਾ ਆ ਤਾਂ ਆਹ ਚੀਜ਼ ਕਰਕੇ ਬੰਦੇ ਨੂੰ ਨਾ ਨਹੀਂ ਹੁੰਦੀ ਕਈ ਵਾਰੀ ਮਨ ਨਹੀਂ ਵੀ ਹੁੰਦਾ ਤਾਂ ਵੀ ਉੱਥੇ ਹਾਂ ਕਰਨੀ ਪੈਂਦੀ ਆ